ਹੈਲੋ ਵਧੀਆ ਖੁਸ਼ਬੂ ਤੂੰ ਸੁਣਾ ਹੋਰ ਕੀ ਕਰੀ ਜਾ ਬਸ ਵਧੀਆ ਵਧੀਆ ਸਭ ਵਧੀਆ ਇੱਥੇ ਤੂੰ ਦੱਸ ਕੀ ਕਰੀ ਜਾਂਦੀ ਵਧੀਆ ਵਧੀਆ ਸਾਰੇ ਵਧੀਆ ਮੈਂ ਕਿਹਾ ਤੂੰ ਦੱਸ ਕਿੱਦਾਂ ਅੱਛਾ ਕੋਲੇਜ ਸੀਗੀ ਠੀਕ ਆ ਠੀਕ ਆ ਮੈਂ ਕਿਹਾ ਮੈਂ ਮੈਂ ਵੀ ਬੱਸ ਇਸ ਟਾਈਮ ਫ੍ਰੀ ਸੀ ਕੋਲੇਜ ਤਾਂ ਅੱਜ ਗਿਆ ਨਹੀਂ ਅੱਜ ਛੁੱਟੀ ਸੀਗੀ ਫੇਰ ਫ੍ਰੀ ਸੀਗਾ ਹੋਰ ਹੋਰ ਮੈਂ ਕਿਹਾ ਤੂੰ ਤਾਂ ਕਰਨਾ ਨਹੀਂ ਮੈਂ ਹੀ ਕਰ ਲਵਾਂ ਹਾਂ ਹੋਰ ਸੁਣਾ ਪੜ੍ਹਾਈ ਬਸ ਚੱਲੀ ਜਾਂਦੀ ਆ ਇਗਜ਼ਾਮ ਆ ਹੁਣ ਮੇਰੇ ਥੋੜ੍ਹੇ ਦਿਨਾਂ ਤੱਕ ਹਾਂ ਅੱਛਾ ਅੱਛਾ ਗੁੱਡ ਨਿਊਜ਼ ਕਿਸ ਚੀਜ਼ ਦੀ ਅੱਛਾ ਜੋਬ ਮਿਲ ਗਈ ਉਹਦੇ ਲਈ ਤਾਂ ਕੌਗ੍ਰੈਚੁਲੇਸ਼ਨ ਬਟ ਡੁਬਈ ਜੋਬ ਮਿਲੀ ਆ ਅੱਛਾ ਅਤੇ ਇੰਨ ਇੰਡੀਆ 'ਚ ਨਹੀਂ ਮਿਲੀ ਕੋਈ ਅੱਛਾ ਅੱਛਾ ਅੱਛਾ ਠੀਕ ਆ ਅਤੇ ਕੀ ਆ ਸੈਲਰੀ ਵਗੈਰਾ ਅੱਛਾ ਵਧੀਆ ਆ ਅਤੇ ਰੂਮ ਵਗੈਰਾ ਦਾ ਕਿੱਦਾਂ ਰਹਿਣ ਦਾ ਅੱਛਾ ਅੱਛਾ ਮਤਲਬ ਸਾਰਾ ਖਾਣਾ ਵਗੈਰਾ ਉਹਨਾਂ ਦਾ ਠੀਕ ਆ ਅਤੇ ਬਾਕੀ ਸੇਫਟੀ ਵਗੈਰਾ ਕਿੱਦਾਂ ਸਾਰੀ ਉੱਥੇ ਅੱਛਾ ਯਾਰ ਅਸੀਂ ਤੈਨੂੰ ਯਾਦ ਕਰਿਆ ਕਰਨਾ ਕਿੱਥੇ ਤੂੰ ਦੁਬਈ ਇੱਥੇ ਬੜਾ ਸੋਹਣਾ ਜੋਬ ਮਿਲ ਜਾਣੀ ਸੀ ਅੱਛਾ ਉਹ ਤਾਂ ਹੈ ਯਾਰ ਫੇਰ ਅੱਛਾ ਬੜੀ ਜਲਦੀ ਅੱਛਾ ਅੱਛਾ ਚੱਲ ਕੋਈ ਨਹੀਂ ਇੱਦਾਂ ਕਰਦਾ ਮੈਂ ਸ਼ਾਮ ਨੂੰ ਤੇਰੀ ਨਾ ਕਾਲ ਕਰ ਗੱਲ ਕਰਾਉਂਦਾ ਮੰਮੀ ਪਾਪਾ ਨਾਲ ਬਾਕੀ ਤੂੰ ਸਾਰਾ ਉਹਨਾਂ ਨਾਲ ਡਿਸਕਸ ਕਰ ਲਈ ਹਾਂ ਹਾਂ ਬਾਕੀ ਉਹਨਾਂ ਨਾਲ ਇੱਕ ਵਾਰੀ ਪੁੱਛ ਲਈ ਨਾ ਸਾਰਾ ਹਾਂ ਠੀਕ ਠੀਕ ਹੈ ਠੀਕ ਹੈ ਬਾਏ ਬਾਏ